ਮੈਂ ਬਚਪਨ ਤੋਂ ਹੀ ਚਿੱਤਰਕਾਰੀ ਦੀ ਬਹੁਤ ਸ਼ੌਕੀਨ ਹਾਂ ਮੈਂ ਸਕੂਲ ਵਿੱਚ ਵੀ ਹਰ ਇੱਕ ਚਿੱਤਰਕਾਰੀ ਦੀ ਵਰਕਸ਼ੋਪ ਦੇ ਵਿੱਚ ਹਿੱਸਾ ਲੈਂਦੀ ਰਹੀ ਹਾਂ ਅਤੇ ਮੈਂ ਹਰੇਕ ਵਰਕਸ਼ੋਪ ਦੇ ਵਿੱਚ ਆਪਣੀ ਚਿੱਤਰਕਾਰੀ ਰੱਖੀ ਹੋਏ ਰੱਖੀ ਸੀ ਅਤੇ ਮੈਂ ਕੋਲਜ ਵਿੱਚ ਵੀ ਹਰੇਕ ਚਿੱਤਰਕਾਰੀ ਦੀ ਵਰਕਸ਼ੋਪ ਦੇ ਵਿੱਚ ਹਿੱਸਾ ਲਿਆ ਹੈ ਅਤੇ ਮੈਂ ਹਰ ਵਾਰ ਕਿਸੇ ਨਾ ਕਿਸੇ ਦਰਜੇ ਉੱਤੇ ਆਉਂਦੀ ਰਹੀ ਹਾਂ